ਹੈਲੋ ਹਾਂਜੀ ਭਾਅ ਜੀ ਨਮਸਕਾਰ ਜੀ ਭਾਅ ਜੀ ਮੇਰਾ ਨਾਮ ਨਾ ਭਵਿਆ ਅਰੋੜਾ ਹੈ ਅਤੇ ਮੈਂ ਨਾ ਤੁਹਾਡੇ ਔਡਰ ਤੁਹਾਡੇ ਢਾਬੇ ਤੋਂ ਔਡਰ ਕੀਤਾ ਹੈ ਹਜੇ ਹੀ ਹਾਂਜੀ ਹਾਂਜੀ ਸਵਿਗੀ ਤੋਂ ਹੀ ਅਤੇ ਦੇਖ ਲਓ ਮੇਰਾ ਨਾਮ ਆ ਰਿਹਾ ਹੋਣਾ ਮੈਂ ਹਜੇ ਦਸ ਕੁ ਮਿੰਟ ਹੀ ਹੋਏ ਔਡਰ ਕੀਤਿਆਂ ਅਤੇ ਮੈਂ ਨਾ ਉਦੋਂ ਐਕਚੁਲੀ ਧਿਆਨ ਨਹੀਂ ਦਿੱਤਾ ਮੈਂ ਚੈੱਕ ਨਹੀਂ ਕੀਤਾ ਬਟ ਮੈਨੂੰ ਹੁਣ ਸ਼ੋਅ ਹੋ ਰਿਹਾ ਕਿ ਜਦੋਂ ਰਾਈਡਰ ਆਏਗਾ ਉਦੋਂ ਸੀ ਓ ਡੀ ਅਵੇਲੇਬਲ ਨਹੀਂ ਹੈਗੀ ਅੱਛਾ ਅੱਛਾ ਨਹੀਂ ਨਹੀਂ ਮੈਂ ਕੈਸ਼ ਔਨ ਡਿਲੀਵਰੀ ਹੀ ਦਵਾਨਾ ਦੇਨਾ ਹੈਗਾ ਅਤੇ ਮੈਂ ਨਾ ਮੇਰੇ ਕੋਲ ਪੇਮੈਂਟ ਮੈਥਡ ਦੂਸਰਾ ਕੋਈ ਨਹੀਂ ਹੈਗਾ ਮੈਂ ਔਨਲਾਈਨ ਕੋਈ ਭੁਗਤਾਨ ਨਹੀਂ ਕਰਨਾ ਅਤੇ ਤੁਸੀਂ ਪਲੀਜ਼ ਆਪਣਾ ਕੈਸ਼ ਔਨ ਡਿਲੀਵਰੀ ਅਵੇਲੇਬਲ ਕਰਾ ਦਿਓ ਜੇ ਕੈਸ਼ ਓਨ ਡਿਲੀਵਰੀ ਨਹੀਂ ਹੋ ਸਕਦਾ ਤਾਂ ਮੈਂ ਜਾਂ ਤਾਂ ਮੇਰਾ ਔਡਰ ਕੈਂਸਲ ਕਰ ਦਿਓ ਤਾਂ ਜੋ ਤੁਹਾਡਾ ਜਿਹੜਾ ਡਿਲੀਵਰੀ ਬੋਆਏ ਆ ਰਿਹਾ ਉਹਨੂੰ ਵੀ ਕੋਈ ਦਿੱਕਤ ਨਾ ਹੋਵੇ ਅਤੇ ਮੈਨੂੰ ਵੀ ਨਾ ਹੋਵੇ ਵਿਚਾਰਾ ਐਨੀ ਦੂਰੋਂ ਆਵੇ ਵੀ ਅਤੇ ਮੇਰੇ ਕੋਲ ਔਨਲਾਈਨ ਦਾ ਕੋਈ ਇੱਥੇ ਹੈ ਨਹੀਂ ਬੰਦੋਬਸਤ ਅਤੇ ਤੁਸੀਂ ਜਾਂ ਤਾਂ ਮੈਨੂੰ ਕੈਸ਼ ਔਨ ਡਿਲੀਵਰੀ ਭੁਗਤਾਨ ਕਰ ਦਿਓ ਮੈਂ ਵੈਸੇ ਵੀ ਮੈਨੂੰ ਤੁਹਾਡੇ ਢਾਬੇ ਦੀ ਰੋਟੀ ਬਹੁਤ ਸਵਾਦ ਲੱਗਦੀ ਹੈ ਅਤੇ ਮੈਨੂੰ ਹੁਣੇ ਹੀ ਦੱਸ ਦਿਓ ਜਿਵੇਂ ਹੋਣਾ ਤਾਂ ਕਿ ਤੁਹਾਡਾ ਵੀ ਟਾਈਮ ਨਾ ਵੇਸਟ ਹੋਵੇ ਅਤੇ ਮੇਰਾ ਵੀ ਨਾ ਹੋਵੇ ਨਹੀਂ ਨਹੀਂ ਤੁਸੀਂ ਜਾਂ ਤਾਂ ਫਿਰ ਆਪਣੇ ਰਾਈਡਰ ਨੂੰ ਕਹਿ ਦਿਓ ਕਿ ਜਾਂ ਤਾਂ ਮੇਰਾ ਔਡਰ ਕੈਂਸਲ ਕਰ ਦਵੇ ਜਾਂ ਤਾਂ ਫਿਰ ਕੈਸ਼ ਔਨ ਡਿਲੀਵਰੀ ਲੈ ਲਵੇ ਥੈਂਕ ਯੂ